ਮੈਂ ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਐਪ ਯੂਜ਼ ਕਰਦਾ ਹਾਂ ਜਿਵੇਂ ਕਿ ਵੱਟਸਅਐਪ ਫੇਸਬੁੱਕ ਇੰਸਟਾਗ੍ਰਾਮ ਸਨੈਪਚੈਟ ਅਤੇ ਹੋਰ ਵੀ ਬਹੁਤ ਸਾਰੇ ਐਪ ਨੇ ਜੋ ਕਿ ਮੇਰੇ ਫੋਨ ਦੇ ਵਿੱਚ ਚਲਦੇ ਹਨ ਅਤੇ ਮੈਂ ਜ਼ਿਆਦਾਤਰ ਫੇਸਬੁੱਕ ਇੰਸਟਾਗ੍ਰਾਮ ਅਤੇ ਸਨੈਪਚੈਟ ਹੀ ਯੂਜ਼ ਕਰਦਾ ਅਤੇ ਇਹਨਾਂ ਵਿੱਚ ਫੋਟੋਜ਼ ਵਗੈਰਾ ਜਾਂ ਵੀਡੀਜ਼ ਵਗੈਰਾ ਅਪਲੋਡ ਕਰਦਾ ਹਾਂ ਅਤੇ ਇਹਨਾਂ ਦੇ ਵਿੱਚ ਜੋ ਕਿ ਇਹਨਾਂ ਦੇ ਕੋਈ ਰੂਲ ਰੈਗੂਲੇਸ਼ਨ ਹੁੰਦੇ ਨੇ ਜਿਹਦੇ ਵਿੱਚ ਆਪਾਂ ਕੋਈ ਗੈਰ ਕਾਨੂੰਨੀ ਜਾਂ ਅਸ਼ਲੀਲ ਵੀਡੀਓ ਫੋਟੋਜ਼ ਵਗੈਰਾ ਜਾਂ ਕੋਈ ਹਥਿਆਰਬੰਦ ਚੀਜ਼ ਜੋ ਕਿ ਆਪਾਂ ਸੋਸ਼ਲ ਮੀਡੀਆ 'ਤੇ ਅਪਲੋਡ ਨਹੀਂ ਕਰ ਸਕਦੇ ਅਤੇ ਮੈਂ ਇਹਨਾਂ ਦੇ ਰੂਲ ਐਰ ਰੈਗੂਲੇਸ਼ਨਾਂ ਦੀ ਬਹੁਤ ਪਾਲਣਾ ਕਰਦਾ ਹਾਂ ਮੈਂ ਕਦੇ ਕੋਈ ਗਲਤ ਚੀਜ਼ ਯੂਜ਼ ਨਹੀਂ ਕਰਦਾ ਇਸ ਵਿੱਚ